ਇ ਇੱਕ ਬਾਈਕਰ ਕੋਲ ਫਸਟ ਏਡ ਦੀ ਕਿੱਟ ਜੋ ਕਿ ਮੈਡੀਕਲ ਨਾਲ ਸੰਬੰਧਿਤ ਹੁੰਦੀ ਹੈ ਉਹ ਹਰ ਇੱਕ ਬਾਈਕ ਜਦੋਂ ਨਿਊ ਬਾਈਕ ਨਵਾਂ ਵਹੀਕਲ ਲੈਂਦੇ ਹਾਂ ਅਤੇ ਉਸ ਦੇ ਨਾਲ ਹੀ ਮਿਲਦੀ ਹੈ ਉਸ ਨੂੰ ਜ਼ਰਾ ਸਾਂਭ ਕੇ ਰੱਖਣੀ ਪੈਂਦੀ ਹੈ ਉਹਦੀ ਐਕਸਪੈਰੀਡੇ ਡੇਟ ਖਤਮ ਹੋਣ ਦੀ ਮਿਤੀ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਉਸ ਤੋਂ ਬਾਅਦ ਉਹ ਸਮਾਨ ਨਾਲ ਨਾਲ ਬਦਲਦੇ ਰਹਿਣਾ ਚਾਹੀਦਾ ਹੈ ਉਸ ਵਿੱਚ ਇੱਕ ਪੱਟੀ ਹੁੰਦੀ ਹੈ ਇੱਕ ਮਲ੍ਹਮ ਹੁੰਦੀ ਹੈ ਨਾਲ ਥੋੜ੍ਹੀ ਸੀ ਥੋੜ੍ਹੀ ਜਿਹੀ ਮੈਡੀ ਮੈਡੀਸਨ ਹੁੰਦੀ ਹੈ ਜੇ ਜਿਹੜੀ ਕਿ ਫਸਟ ਏਡ ਕਿ ਕਿਸੇ ਕਾਰਨ ਕਰਕੇ ਸੱਟ ਲੱਗ ਜਾਵੇ ਉਸ ਦੇ ਨਾਲ ਉਸ ਨੂੰ ਵਰਤਿਆ ਜਾ ਸਕੇ ਇਸ ਤੋਂ ਇਲਾਵਾ ਬਾਈਕਰ ਕੋਲ ਪੈਂਚਰ ਹੋਣ ਦੀ ਸਥਿਤੀ ਵਿੱਚ ਜਿਹੜਾ ਸਮਾਨ ਜ ਬਾਈਕ ਦੇ ਨਾਲ ਆਉਂਦਾ ਹੈ ਉਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤਾਂ ਜੋ ਕਿਤੇ ਟਾਇਰ ਪੰਚਰ ਹੋ ਜੇ ਜਾਂ ਕੁਛ ਵੀ ਅਣਸਖਾਵੀਂ ਘਟਨਾ ਹੋ ਜੇ ਤਾਂ ਉਸ ਨੂੰ ਵਰਤਿਆ ਜਾ ਸਕਦਾ ਹੈ ਇਹ ਬਾਈਕਰ ਦੇ ਕੋਲ ਮੋਟਰਸਾਇ ਏਹ ਟੂ ਵੀਲਰ ਦੇ ਵਿੱਚ ਹੋਣਾ ਜ਼ਰੂਰੀ ਚਾਹੀਦਾ ਹੈ ਅਤੇ ਇਸ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਮੈਡੀਕਲ ਸੰਬੰਧਿਤ ਦੇ ਨਾਲ ਜਿਹੜਾ ਉਹ ਡੀ ਜਿਹੜੇ ਤਾਰੀਕ ਆ ਉਸਦੀ ਉਹ ਖਤਮ ਹੋਣ ਤੋਂ ਪਹਿਲਾਂ ਬਦਲ ਲੈਣਾ ਚਾਹੀਦਾ ਹੈ